ਮੈਨੂੰ ਪਕਵਾਨ ਬਣਾਉਣ ਦਾ ਬਹੁਤ ਸ਼ੌਂਕ ਹੈ ਪਰ ਸਭ ਤੋਂ ਵਧੀਆ ਪਕਵਾਨ ਮੈਂ ਮੈਗੀ ਬਣਾਉਂਦੀ ਹਾਂ ਕਿਉਂਕਿ ਇੱਕ ਤਾਂ ਇਹਨੂੰ ਬਣਾਉਣ ਲਈ ਸਮਾਂ ਬਹੁਤ ਘੱਟ ਲੱਗਦਾ ਹੈ ਅਤੇ ਥੋੜ੍ਹੇ ਸਮੇਂ ਦੇ ਵਿੱਚ ਮੈਂ ਆਪਣੀ ਭੁੱਖ ਨੂੰ ਸੰਤੁਸ਼ਟ ਕਰ ਸਕਦੀ ਹਾਂ